ਮੈਨੂੰ ਸ ਸਿਲਾਈ ਬੁਣਾਈ ਦਾ ਬਹੁਤ ਸ਼ੌਕ ਸੀਗਾ ਕੱਪੜੇ ਬੁਣਨ ਦਾ ਵੀ ਆਹ ਕੋਟੀਆਂ ਕਾਟੀਆਂ ਅਤੇ ਕੱਪ ਸਿਲਾਈ ਦਾ ਵੀ ਬਹੁਤ ਸ਼ੌਕ ਸੀਗਾ ਅਤੇ ਮੈਂ ਨਾ ਬੱਚਿਆਂ ਦੇ ਛੋਟੇ ਹੁੰਦਿਆਂ ਦੇ ਇਹਨਾਂ ਦੇ ਸੀ ਸੀ ਕੇ ਪਾਉਂਦੀ ਰਹੀ ਆਪ ਹੀ ਥੋੜ੍ਹਾ ਮੈਨੂੰ ਗਲੇ ਤੋਂ ਥੋੜ੍ਹਾ ਸੀਗਾ ਆਪਣਾ ਉਹ ਦਿੱਕਤ ਜਿਹੀ ਉਹ ਮੇਰੀ ਸੱਸ ਨੇ ਮੈਨੂੰ ਦੱਸ ਦਿੱਤਾ ਸੀ ਉਹਨਾਂ ਨੇ ਗਲੇ ਬਣਾਉਣੇ ਨਹੀਂ ਸੀ ਆਉਂਦੇ ਉਹਨਾਂ ਨੇ ਦੱਸਿਆ ਅਤੇ ਦੂਸਰਾ ਕੱਪੜੇ ਕੁਪੜੇ ਬਣਾਉਣ ਦਾ ਵੀ ਸ਼ੌਕ ਸੀ ਆਹ ਸੀਣ ਦਾ ਵੀ ਸ਼ੌਕ ਸੀ ਉਹ ਵੀ ਸੀਂਦੇ ਸੀ ਬੱਚਿਆਂ ਦੇ ਜਿੱਦਾਂ ਆਪਣੇ ਪਜਾਮੀਆਂ ਪੁਜਾਮੀਆਂ ਵਗੈਰਾ ਤਾਂ ਫਿਰ ਇੱਦਾਂ ਸੂਟ ਸਾਟ ਵੀ ਆਉਣੇ ਆ ਗਏ ਸੀ ਸੀਣੇ ਤਾਂ ਫਿਰ ਆਹ ਆਹਾ ਕੋਟੀਆਂ ਦੀ ਬੁਣਤੀਆਂ ਬਣਤੀਆਂ ਵੀ ਦਾ ਸ਼ੌਕ ਸੀਗਾ ਅਤੇ ਪਹਿਲਾਂ ਮੈਂ ਮਾੜਾ ਮੋਟਾ ਬੁਣਦੀ ਰਹੀ ਉਸ ਤੋਂ ਬਾਅਦ ਫਿਰ ਮੈਨੂੰ ਆ ਗਿਆ ਸੀ ਬੁਣਨਾ ਵਧੀਆ ਉਹ ਤਾਂ ਮੇਰੀ ਸੱਸ ਨੇ ਸਿਖਾ ਦਿੱਤਾ ਸੀ ਇਹਨਾਂ ਨੇ ਮੈਨੂੰ ਤਾਂ ਫਿਰ ਮੈਂ ਆਪ ਬੱਚਿਆਂ ਦੇ ਬੁਣ ਲੈਂਦੀ ਸੀ ਬੁਣਤੀਆਂ ਤਾਂ ਵੀ ਆ ਗਈਆਂ ਸੀਗੀਆਂ ਤਾਂ ਥੋੜ੍ਹਾ ਗਲਾ ਵੀ ਗਲਾ ਔਖਾ ਸੀ ਉਹ ਤਿੰਨ ਸਲਾਈਆਂ ਨਾਲ ਫਿਰ ਉਹਨਾਂ ਨੇ ਮੈਨੂੰ ਸਿਖਾ ਦਿੱਤਾ ਸੀ ਫਿਰ ਮੈਨੂੰ ਹੌਲੀ ਹੌਲੀ ਆ ਗਿਆ ਸੀ ਤਾਂ ਮੈਂ ਸਿਲਾਈ ਵੀ ਫਿਰ ਸਿੱਖ ਸਿੱਖ ਗਈ ਸੀਗੀ ਮਾੜੇ ਮੋਟੇ ਆਪਣੇ ਘਰ ਘੁਰੇ ਪਾਉਣ ਨੂੰ ਸੀ ਲਈਦੇ ਆ ਕੱਪੜੇ ਸ ਬਾ ਬਹੁਤ ਬਹੁਤ ਤੁਹਾਡਾ ਧੰਨਵਾਦ